ਪੰਜਾਬ ਵਿੱਚ ਸਰਕਾਰੀ ਲੋਕ ਸੇਵਾ ਕੇਂਦਰ ਡਿਸਪੈਂਸਰੀਆਂ ਸਰਕਾਰੀ ਹੋਸਪਿਟਲ ਸਰਕਾਰੀ ਡਿਸਪੈਂਸਰੀਆਂ ਦਾ ਪ੍ਰਬੰਧ ਹੈ ਅਤੇ ਇਹਨਾਂ ਤੋਂ ਬਹੁਤ ਵਧੀਆ ਸਹੂਲਤਾਂ ਮਿਲਦੀਆਂ ਹਨ ਜਿਵੇਂ ਕਿ ਸਰਕਾਰੀ ਹੋਸਪੀਟਲ ਉਥੋਂ ਫਰੀ ਦਵਾਈਆਂ ਫਰੀ ਟੈਸਟ ਦਾ ਪ੍ਰਬੰਧ ਸਰਕਾਰ ਨੇ ਕੀਤਾ ਹੋਇਆ ਹੈ ਜਿਵੇਂ ਕਿ ਆਂਗਨਵਾੜੀ ਉਥੋਂ ਬੱਚਿਆਂ ਨੂੰ ਖਾਣਾ ਗਰਭਵਤੀ ਔਰਤਾਂ ਨੂੰ ਖਾਣਾ ਮਿਲਦਾ ਹੈ ਅਤੇ ਜਿਵੇਂ ਸੇਵਾ ਕੇਂਦਰ ਉੱਤੇ ਆਧਾਰ ਕਾਰਡ ਹੋਰ ਵੀ ਬਹੁਤ ਸਾਰੇ ਕੰਮ ਮਿੰਟੋ ਮਿੰਟ ਬਹੁਤ ਹੀ ਚੰਗੀ ਸਹੂਲਤ ਨਾਲ ਮਿਲਦਾ ਹੈ